ਮੈਂ ਕ੍ਰਿਕਟ ਖੇਡਣ ਦੇ ਨਾਲ ਦੇ ਨਾਲ ਅਥਲੈਟਿਕਸ ਦੇ ਵਿੱਚ ਵੀ ਪਾਰਟ ਲਿੱਤਾ ਹੈ ਜਿਵੇਂ ਕਿ ਸੌ ਮੀਟਰ ਦੀ ਰੇਸ ਦੋ ਸੌ ਮੀਟਰ ਦੀ ਰੇਸ ਤਿੰਨ ਸੌ ਮੀਟਰ ਦੀ ਰੇਸ ਅਤੇ ਅੱਠ ਸੌ ਮੀਟਰ ਦੀ ਰੇਸ ਇਸ ਕਿਉਂਕਿ ਇਹ ਮੈਨੂੰ ਕ੍ਰਿਕਟ ਦੇ ਵਿੱਚ ਵੀ ਬਹੁਤ ਮਦਦ ਕਰਦੇ ਹਨ ਜਿਵੇਂ ਕਿ ਸੌ ਮੀਟਰ ਦੀ ਰੇਸ ਦੇ ਵਿੱਚ ਸਾਨੂੰ ਤੇਜ਼ ਤੋਂ ਤੇਜ਼ ਭੱਜਣਾ ਹੁੰਦਾ ਉਹ ਮੈਨੂੰ ਰਨਅਪ ਦੇ ਵਿੱਚ ਵੀ ਹੈਲਪ ਕਰਦਾ ਹੈ ਅਤੇ ਦੋ ਸੌ ਮੀਟਰ ਦੀ ਰੇਸ ਵੀ ਮੈਨੂੰ ਪਸੰਦ ਹੈ ਕਰਨੀ ਅਤੇ ਅੱਠ ਸੌ ਮੀਟਰ ਵਾਲੀ ਰੇਸ ਵੀ ਬਹੁਤ ਕਰਨੀ ਪਸੰਦ ਹੈ ਕਿਉਂਕਿ ਇਹ ਅੱਠ ਸੌ ਮੀਟਰ ਵਾਲੀ ਰੇਸ ਦੇ ਨਾਲ ਸਾਡਾ ਸਟੈਮਨਾ ਵੀ ਵੱਧਦਾ ਹੈ ਉਸ ਦੇ ਉਸ ਰੇਸਾਂ ਉਹਨਾਂ ਰੇਸਾਂ ਕਾਰਨ ਦੇ ਮੇਰਾ ਸਟੈਮਨਾ ਵੀ ਬਹੁਤ ਜ਼ਿਆਦਾ ਵਧੀਆ ਵਧਿਆ ਹੈ ਅਤੇ ਮੈਂ ਕ੍ਰਿਕਟ ਦੇ ਵਿੱਚ ਵੀ ਬਹੁਤ ਜ਼ਿਆਦਾ ਅੱਗੇ ਵੱਧ ਪਾਇਆ ਹਾਂ ਕਿਉਂਕਿ ਕ੍ਰਿਕਟ ਦੇ ਵਿੱਚ ਸਾਨੂੰ ਵੀ ਸਟੈਮਨਾ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਕ੍ਰਿਕਟ ਕਿਉਂਕਿ ਇਸ ਗੇਮ ਦੇ ਵਿੱਚ ਸਾਨੂੰ ਭੱਜਣਾ ਵੀ ਬਹੁਤ ਤੇਜ਼ ਹੁੰਦਾ ਹੈ ਅਤੇ ਨਾਲੇ ਬੋਲ ਨੂੰ ਰੋਕਣ ਵਾਸਤੇ ਵੀ ਬਹੁਤ ਬਹੁਤ ਜ਼ਿਆਦਾ ਤੇਜ਼ ਭੱਜਣਾ ਪੈਂਦਾ ਹੈ ਉਸ ਕਰਕੇ ਸਾਨੂੰ ਸਟੈਮਨੇ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਕਿਉਂ ਅਥਲੈਟਿਕਸ ਦੇ ਵਿੱਚ ਪਾਰਟ ਲੈਂਦੇ ਲੈਂਦੇ ਮੇਰਾ ਸਟੈਮਨਾ ਇੰਨਾ ਜ਼ਿਆਦਾ ਵੱਧ ਗਿਆ ਹੈ ਕਿਉਂ ਉਸ ਦੇ ਨਾਲ ਨਾਲ ਮੈਂ ਅਥਲੈਟਿਕਸ ਦੇ ਵਿੱਚ ਗੋਲਡ ਮੈਡਲ ਸਿਲਵਰ ਮੈਡਲ ਅਤੇ ਬਰੋਸ ਮੈਂਡਲ ਵੀ ਲੈ ਕੇ ਆਇਆ ਹੋਇਆ ਹਾਂ ਅਤੇ ਮੇਰੇ ਘਰ ਦੇ ਉਸ ਚੀਜ਼ ਨੂੰ ਵੀ ਬੜਾ ਪਰਾਊਡ ਮਾਣ ਕਰਦੇ ਹਨ ਕਿ ਸਾਡਾ ਮੁੰਡਾ ਇਲੈਕਟ ਅਥਲੈਟਿਕਸ ਦੇ ਵਿੱਚ ਵੀ ਇੱਕ ਪਾਰਟ ਲੈ ਰਿਹਾ ਹੈ ਅਤੇ ਇੱਕ ਗੇਮ ਵੀ ਕਰ ਰਿਹਾ ਹੈ ਅਤੇ ਮੈਂ ਅਥਲੈਟਿਕਲਸ ਦੇ ਵਿੱਚ ਵੀ ਜੋਨਲ 'ਤੇ ਡਿਸਟਰਿਕਟ ਖੇਡ ਕੇ ਆਇਆ ਹੋਇਆ ਹਾਂ ਜਿਸ ਦੇ ਵਿੱਚ ਮੈਨੂੰ ਜੋਨਲ ਦੇ ਵਿੱਚ ਸਿਲਵਰ ਮੈਡਲ ਅਤੇ ਅਤੇ ਮੈਨੂੰ ਡਿਸਟ੍ਰਿਕ ਦੇ ਵਿੱਚ ਗੋਲਡ ਮੈਡਲ ਸੌ ਅਤੇ ਦੋ ਸੌ ਮੀਟਰ ਦੀ ਰੇਸ ਦੇ ਲਈ ਵੀ ਮਿਲਿਆ ਹੈ ਅਤੇ ਅੱਠ ਸੌੌ ਮੀਟਰ ਦੇ ਲਈ ਮੈਨੂੰ ਦੋਨਾਂ ਦੇ ਵਿੱਚ ਬ੍ਰੋਨਸ ਮੈਡਲ ਮਿਲਿਆ ਸੀ ਅਤੇ ਇਸ ਦੇ ਨਾਲ ਨਾਲ ਮੈਨੂੰ ਕ੍ਰਿਕਟ ਦੇ ਵਿੱਚ ਨੈਸ਼ਨਲ ਟੀਮ ਦੇ ਲਈ ਸਲੈਕਟ ਵੀ ਕਰਿਆ ਗਿਆ ਹੈ ਕਿਉਂਕਿ ਮੈਂ ਇੱਕ ਬਹੁਤ ਫੁਰਤੀਲਾ ਖਿਡਾਰੀ ਹਾਂ ਜਿਸ ਦਾ ਕਾਰਨ ਹੈ ਮੇਰੇ ਅਥਲੈਟਿਕਸ ਦੀ ਖੇਡਾਂ ਅਤੇ ਅਤੇ ਮੇਰੇ ਕੋਚ ਸਾਹਿਬ ਜਿਹੜੇ ਮੈਨੂੰ ਬਹੁਤ ਜ਼ਿਆਦਾ ਟ੍ਰੇਨ ਕਰਦੇ ਹਨ ਉਹ ਵੀ ਮੇਰੇ 'ਤੇ ਬਹੁਤ ਜ਼ਿਆਦਾ ਮਾਣ ਕਰ ਰਹੇ ਹਨ ਜਿਸ ਦੇ ਕਾਰਨ ਮੈਂ ਅੱਗੋਂ ਬਹੁਤ ਜ਼ਿਆਦਾ ਅੱਗੇ ਵੱਧ ਰਿਹਾ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਅਤੇ ਮੈਂ ਆਪਣਾ ਸੁਪਨਾ ਵੀ ਹਰ ਸੁਪਨਾ ਪੂਰਾ ਕਰ ਪਾ ਰਿਹਾ ਹਾਂ ਇੱਕ ਦਿਨ ਮੈਨੂੰ ਉਮੀਦ ਹੈ ਕਿ ਮੈਂ ਅਥਲੈਟਿਕਸ ਦੇ ਨਾਲ ਦੇ ਨਾਲ ਕ੍ਰਿਕਟ ਦੇ ਵਿੱਚ ਵੀ ਦੁਨੀ ਆਪਣੇ ਦੇਸ਼ ਨੂੰ ਰੀਪ੍ਰਜੈਂਟ ਕਰ ਪਾਵਾਂ ਅਤੇ ਮੈਂ ਦਿਨੋਂ ਦਿਨ ਹੀ ਆਪਣੀ ਇਸ ਗੇਮ ਦੇ ਪ੍ਰਤੀ ਬਹੁਤ ਡੈਡੀਕੇਸ਼ਨ ਦੇ ਨਾਲ ਪ੍ਰੈਕਟਿਸ ਕਰ ਰਿਹਾ ਹਾਂ ਅਤੇ ਹੌਲੀ ਹੌਲੀ ਮੈਂ ਆਪਣਾ ਕਰੀਅਰ ਇਸ ਚੀਜ਼ ਦੇ ਵਿੱਚ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਜਿਵੇਂ ਹੋ ਸਕਿਆ ਤਾਂ ਮੈਂ ਹੋਰ ਵੀ ਅੱਗੇ ਇਸ ਦੇ ਵਿੱਚ ਜਾਣਾ ਚਾਵਾਂਗਾ ਅਤੇ ਮੈਂ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਜਿਵੇਂ ਜਿਵੇਂ ਮੇਰਾ ਟਾਈਮ ਨਿਕਲਦਾ ਜਾਵੇਗਾ ਤਾਂ ਮੈਂ ਹੋਰ ਜ਼ਿਆਦਾ ਇਸ ਪਰਾ ਇਸ ਦੇ ਪ੍ਰਤੀ ਮੈਂ ਪ੍ਰੈਕਟਿਸ ਕਰਾਂਗਾ ਅਤੇ ਮੈਂ ਇਸ ਦੇ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਅਤੇ ਰ ਮੈਂ ਆਪਣੀ ਪ੍ਰਤੀ ਆਪਣੀ ਹਰ ਚੀਜ਼ ਪ੍ਰਤੀ ਮੈਂ ਆਪਣੀ ਪੂਰੀ ਡੈਡੀਕੇਸ਼ਨ ਦੇ ਨਾਲ ਕਰ ਰਿਹਾ ਹਾਂ ਅਤੇ ਜਿਵੇਂ ਜਿਵੇਂ ਮੈਂ ਅੱਗੇ ਵਧਾ ਹਾਂ ਤਾਂ ਮੈਂ ਆਪਣਾ ਪੂਰਾ ਸਮਰਥ ਦੇਵਾਂ ਉਸ ਚੀਜ਼ ਨੂੰ ਅਤੇ ਮੈਂ ਜਿੱਤ ਸਕਾਂ ਆਪਣੇ ਅਤੇ ਆਪਣੇ ਮੁਕਾਮ 'ਤੇ ਹਾਸਿਲ ਆਪਣਾ ਮੁਕਾਮ ਵੀ ਹਾਸਿਲ ਕਰ ਪਾਵਾਂ ਮੈਂ